ਇੱਕ ਨਵੀਂ ਕੰਪਨੀ ਦਾ ਮੈਂ ਲੈਪਟੋਪ ਲੈ ਕੇ ਆਇਆ ਸੀ ਜਦੋਂ ਮੈਂ ਉਸ ਦੀ ਵਰਤੋਂ ਕੀਤੀ ਤਾਂ ਉਸਦਾ ਪ੍ਰੋਸੈਸਰ ਵਧੀਆ ਨਹੀਂ ਸੀ ਚੁੱਕਣ ਵਿੱਚ ਵੀ ਇਹ ਇੱਕ ਆਮ ਲੈਪਟੋਪ ਨਾਲੋਂ ਭਾਰਾ ਸੀ ਜਦੋਂ ਮੈਂ ਉਸ ਨੂੰ ਚਲਾਉਂਦਾ ਸੀ ਤਾਂ ਉਸਦੀ ਬੈਟਰੀ ਜ਼ਿਆਦਾ ਟਾਇਮ ਨਹੀਂ ਕੱਢਦੀ ਸੀ ਇਸ ਲਈ ਮੈਨੂੰ ਇਸ ਪ੍ਰੋਡਕਟ ਦਾ ਤਜ਼ਰਬਾ ਮੇਰੇ ਲਈ ਵਧੀਆ ਨਹੀਂ ਰਿਹਾ